ਮੈਂ ਕਵਿਤਾ ਮੇਰੇ ਨਾਲ ਦੋ ਹੋਰ ਵਿਅਕਤੀਆਂ ਨੇ ਰਲ ਕੇ ਅਸੀਂ ਲਿਖੀ ਦੁਨੀਆਂ ਮਤਲਬ ਦੀ ਸੋ ਇਹ ਦੁਨੀਆ ਜੋ ਆਪਣੇ ਹੀ ਸਵਾਰਥਾਂ ਦੇ ਨਾਲ ਮਤਲਬ ਰੱਖਦੀ ਹੈ ਜਦੋਂ ਕਿਸੇ ਦਾ ਸਵਾਰਥ ਹੋ ਜਾਂਦਾ ਹੈ ਸਭ ਛੱਡ ਕੇ ਆਪੋ ਆਪਣੇ ਰਸਤੇ ਪੈਂਦੇ ਹਨ ਸੋ ਇਹ ਦੁਨੀਆ ਮਤਲਬ ਦੀ ਹੈ ਇਹਦੇ 'ਤੇ ਅਸਾਂ ਨੇ ਪੰਜਾਬੀ ਦੇ ਵਿੱਚ ਜੋ ਅਸੀਂ ਇਹ ਕਵਿਤਾ ਲਿਖੀ ਸੀ ਅਸੀਂ ਪੰਜਾਬੀ ਭਾਸ਼ਾ ਨੂੰ ਲਿਖਣਾ ਪਸੰਦ ਕਰਦੇ ਹਾਂ